ਆ ਹਾਂਜੀ ਅਸੀਂ ਵਰਚੁਅਲ ਰਿਆਲਟੀ ਗੇਮ ਖੇਡੀ ਆ ਕਿਅ ਵਰਚੁਅਲ ਰ ਰਿਐਲਿਟੀ ਗੇਮ ਜਿੱਦਾਂ ਕਿ ਫਰੀ ਫਾਇਰ ਖੇਡੀ ਆ ਉਸ ਦੇ ਵਿੱਚ ਮਤਲਬ ਮੋਸਟਲੀ ਇੱਦਾਂ ਹੁੰਦਾ ਕਿ ਅਸੀਂ ਵੈਪਨਸ ਵਗੈਰਾ ਦੀ ਵਰਤੋਂ ਕਰਦੇ ਹਾਂ ਅਤੇ ਮਤਲਬ ਮਨੁੱਖ ਵਗੈਰਾ ਉਹਦੇ ਵਿੱਚ ਹੁੰਦੇ ਨੇ ਤਾਂ ਆਪਾਂ ਨੂੰ ਇੱਦਾਂ ਹੀ ਫੀਲ ਹੁੰਦਾ ਜਦੋਂ ਆਪਾਂ ਗੇਮ ਖੇਡਦੇ ਹਾਂ ਤਾਂ ਆਪਾਂ ਨੂੰ ਇੱਦਾਂ ਹੀ ਫੀਲ ਹੁੰਦਾ ਕਿ ਆਪਾਂ ਖੁਦ ਉਸ ਗੇਮ 'ਚ ਵਿੱਚ ਪਾਰਟੀਸਪੇਟ ਕਰ ਰਹੇ ਹਾਂ ਅਤੇ ਆਪਣੇ ਖੁਦ ਦੇ ਹੱਥ ਵਿੱਚ ਵੈਪਨਸ ਨੇ ਅਤੇ ਆਪਾਂ ਖੁਦ ਹੀ ਉਹਨਾਂ 'ਤੇ ਅ ਫਾਇਰਿੰਗ ਵਗੈਰਾ ਕਰ ਰਹੇ ਹਾਂ ਉਹਨਾਂ ਨਾਲ ਖੇਡ ਰਹੇ ਹਾਂ ਅਤੇ ਆਪਾਂ ਉਹਨਾਂ ਨੂੰ ਲੱਭ ਰਹੇ ਹਾਂ ਜਾਂ ਕੁਛ ਵੀ ਉਹਦੇ ਵਿੱਚ ਜੇ ਕੋਈ ਮਤਲਬ ਬਾਈਕ ਵਗੈਰਾ ਜਾਂ ਕਾਰ ਵਗੈਰਾ ਨੇ ਤਾਂ ਆਪਾਂ ਖੁਦ ਹੀ ਉਹਨਾਂ ਨੂੰ ਡਰਾਈਵ ਕਰ ਰਹੇ ਹਾਂ ਤਾਂ ਆਪਾਂ ਨੂੰ ਇਹ ਮਹਿਸੂਸ ਹੁੰਦਾ ਕਿ ਜਦੋਂ ਆਪਾਂ ਗੇਮ ਖੇਡਦੇ ਕਿ ਤਾਂ ਉਹਦੇ ਵਿੱਚ ਅਸੀਂ ਖੁਦ ਇਨਵੋਲਵ ਹੁੰਦੇ ਹਾਂ ਅਤੇ ਇਹ ਗੇਮਸ ਮਤਲਬ ਬਹੁਤ ਤਰੀਕੇ ਨਾਲ ਖੇਡੀ ਜਾਂਦੀ ਹੈ ਜਿੱਦਾਂ ਕਿ ਕਿਸੇ ਨੂੰ ਮਾਰਨਾ ਕਰਨਾ ਜਾਂ ਕਿਸੇ ਦੇ ਸ਼ੂਟ ਕਰਨਾ ਕੁਛ ਵੀ ਇੱਦਾਂ ਦੀਆਂ ਕਰਕੇ ਵੀ ਮਤਲਬ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਗੇਮ ਦੇ ਵਿੱਚ ਹੁੰਦੀਆਂ ਨੇ ਸਾਡੇ ਕੋਲ ਇੱਦਾਂ ਲੱਗਦਾ ਕਿ ਵੈਪਨਸ ਵੀ ਖੁਦ ਦੇ ਨੇ ਅਤੇ ਜਿੱਦਾਂ ਖੇਡ ਰਹੇ ਹਾਂ ਆਪਣੇ ਵਹੀਕਲ ਵੀ ਖੁਦ ਨੇ ਤਾਂ ਸਾਨੂੰ ਇਹ ਹੀ ਮਹਿਸੂਸ ਹੁੰਦਾ ਕਿ ਅਸੀਂ ਗੇਮ ਦੇ ਵਿੱਚ ਖੁਦ ਹੀ ਪਾਰਟੀਸਪੇਟ ਆ